ਹਾਂਜੀ ਮੈਂ ਤੁਹਾਨੂੰ ਦੱਸਣਾ ਚਾਹੂੰਗਾ ਵੀ ਮੈਂ ਔਨਲਾਈਨ ਸ਼ੂਜ ਬਾਏ ਕੀਤੇ ਸੀਗੇ ਫਲਿੱਪਕਾਟ ਐਪ ਤੋਂ ਜੋ ਕਿ ਬਹੁਤ ਵਧੀਆ ਸੀਗੇ ਉਹ ਸ਼ੂਜ਼ ਮੇਰੇ ਫੇਵਰੇਟ ਹਨ ਅਤੇ ਉਹ ਸ਼ੂਜ਼ ਪਿਊਮਾ ਕੰਪਨੀ ਦੇ ਸੀਗੇ ਸਪੋਰਟ ਸ਼ੂਜ਼ ਸੀਗੇ ਅਤੇ ਬਹੁਤ ਕੰਫਰਟੇਬਲ ਸੀਗੇ ਉਹਦੇ ਦੋ ਕਲਰ ਸੀਗੇ ਇੱਕ ਔਰੇਂਜ ਇੱਕ ਵ੍ਹਾਈਟ ਡਬਲ ਸ਼ੇਡ ਸੀਗੀ ਉਹ ਕਲਰ ਦੀ ਅਤੇ ਉਹ ਕਲਰ ਵਿੱਚ ਮਤਲਬ ਦੋ ਪੀਸ ਸੀਗੇ ਇੱਕ ਪੀਸ ਜਿਹੜਾ ਮੈਨੂੰ ਫੇਵਰੇਟ ਸੀਗਾ ਮੇਰਾ ਅਵੇਲੇਬਲ ਸੀਗਾ ਉਹ ਮੈਂ ਬਾਏ ਕੀਤਾ ਅਤੇ ਉਸ ਤੋਂ ਬਾਅਦ ਅਤੇ ਉਹਦੀ ਗ੍ਰਿਪ ਬਹੁਤ ਵਧੀਆ ਸੀਗੀ ਪੈਰ ਵਿੱਚ ਮਤਲਬ ਪੂਰਾ ਸ਼ੋਫਟ ਰਹਿੰਦਾ ਸੀਗਾ ਨਾ ਕੋਈ ਛਾਲਾ ਨਾ ਕੋਈ ਕੁਛ ਤੰਗ ਕਰਦਾ ਸੀਗਾ ਰਨਿੰਗ ਵਿੱਚ ਵੀ ਬਹੁਤ ਵਧੀਆ ਸੀਗਾ ਅਤੇ ਉਹਦੇ ਪ੍ਰਾਈਜ਼ ਬਹੁਤ ਵਧੀਆ ਸੀਗਾ ਮੈਨੂੰ ਲੈਸ ਹੋ ਕੇ ਮਿਲਿਆ ਸੀਗਾ ਅਤੇ ਸੱਤਰ ਪ੍ਰਸੈਂਟ ਔਫ ਲੱਗੀ ਸੀਗੀ ਅਤੇ ਜਦ ਮੈਂ ਔਡਰ ਕੀਤਾ ਸੀਗਾ ਔਡਰ ਆਉਣ ਤੋਂ ਬਾਅਦ ਹਫਤੇ ਦੀ ਡਿਲੀਵਰੀ ਤੋਂ ਬਾਅਦ ਜਦ ਮੈਂ ਉਹਨੂੰ ਖੋਲ੍ਹਿਆ ਮੇਰਾ ਫੇਵਰੇਟ ਸ਼ੂਜ਼ ਆ ਉਹ ਹੁਣ ਵੀ ਆ ਅਤੇ ਪਿਊਮਾ ਦਾ ਸੀਗਾ ਦੈਨ ਜਦੋਂ ਮੈਂ ਉਹਨੂੰ ਯੂਜ ਕੀਤਾ ਅਤੇ ਮੈਂ ਉਹਨੂੰ ਪਾਇਆ ਬਹੁਤ ਵਧੀਆ ਉਹਦੀ ਕੁਆਲਿਟੀ ਸੀਗੀ ਵੋਟਰਪਰੂਵ ਵੀ ਸੀਗਾ ਉਹ ਉਹਦੇ ਵਿੱਚ ਲਿਖ ਮੈਨਸ਼ਨ ਸੀਗਾ ਵੀ ਵਾਟਰਪਰੂਵ ਆ ਉਹ ਅਤੇ ਸਾਰਾ ਕੁਛ ਸੀਗਾ ਉਹਦੀ ਕੁਆਲਿਟੀ ਉਹਦਾ ਲ ਜਿਹੜਾ ਲੈਦਰ ਸੀਗਾ ਉਹਦਾ ਥੱਲੇ ਸੋਲ ਸੀਗਾ ਉਹ ਬਹੁਤ ਵਧੀਆ ਸੀਗਾ ਪ੍ਰੋਪਰ ਸੀਗਾ ਮੈਂਟੇਨ ਸੀਗਾ ਮੋਟਾ ਸੀਗਾ ਦੈਨ ਉਹਦੇ ਉੱਪਰ ਇੰਸਟਰਕਸ਼ਨ ਵੀ ਸੀਗੀਆਂ ਵੀ ਇਹਨੂੰ ਕਿੱਥੇ ਕਿੱਥੇ ਯੂਜ਼ ਕਰਨਾ ਕਿਵੇਂ ਕਰਨਾ ਕਿਵੇਂ ਇਹਨੂੰ ਵੋਸ਼ ਕਰਨਾ ਉਹ ਪ੍ਰੋਪਰ ਉਹਨੂੰ ਦੱਸਿਆ ਗਿਆ ਸੀਗਾ ਉਹਦੇ ਬਾਰੇ ਵੀ ਇਹਨੂੰ ਐਵੇਂ ਧੋਣਾ ਐਵੇਂ ਇਹ ਕਰਨਾ ਇਹਦੇ ਨਾਲ ਐਵੇਂ ਤਾਂ ਉਹਨੂੰ ਗਾਈਡਲਾਈਨ ਨੂੰ ਫੋਲੋ ਕਰਕੇ ਸਾਰਾ ਕੁਛ ਹੁਣ ਤੱਕ ਉਹ ਸ਼ੂਜ਼ ਮੈਨੂੰ ਵਧੀਆ ਚੱਲੀ ਜਾਂਦੇ ਨੇ ਅਤੇ ਬਹੁਤ ਵਧੀਆ ਮੈਨੂੰ ਉਹ ਨੇ ਬੈਕਅਪ ਦਿੱਤਾ ਇਹ ਜੋ ਮੈਂ ਔਡਰ ਕੀਤਾ ਸੀਗਾ ਮੈਨੂੰ ਸ਼ੂਜ਼ ਪਿਊਮਾ ਦੇ ਬਹੁਤ ਵਧੀਆ ਸੀਗੇ ਮੇਰੇ ਲਈ ਅਤੇ ਮੈਂ ਅੱਗੇ ਵੀ ਕੋਸ਼ਿਸ਼ ਕਰਾਂਗਾ ਵੀ ਅੱਗੇ ਵੀ ਜੇ ਲੈਸ ਲੱਗੇ ਤਾਂ ਵਧੀਆ ਅਤੇ ਮੈਂ ਇਹ ਹੀ ਸੇਮ ਸ਼ੂਜ਼ ਪਿਊਮਾ ਦੇ ਦੁਬਾਰਾ ਫਿਰ ਤੋਂ ਔਡਰ ਕਰਾਂ